ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਨਾ ਪਾਹਲਪ੍ਰੀਤ ਸਿੰਘ ਬੋਲ ਰਿਹਾ ਵਾਂ ਅਤੇ ਮੈਂ ਨਾ ਬੀਟੈਕ ਸੀ ਐਸ ਸੀ ਕਰਦਾ ਪਿਆ ਸੀ ਫਸਟ ਈਅਰ 'ਚ ਅਤੇ ਮੈਂ ਨਾ ਤੁਸੀਂ ਅਮਨ ਜੀ ਬੋਲ ਰਹੇ ਹੋ ਯੋਗਾ ਅਧਿਆਪਕ ਹਾਂਜੀ ਮੈਂ ਨਾ ਮੈਨੂੰ ਯੋਗਾ ਬਾਰੇ ਨਾ ਕੁਛ ਜਾਣਕਾਰੀ ਚਾਹੀਦੀ ਸੀਗੀ ਅਤੇ ਮੈਂ ਅੱਜ ਕੱਲ੍ਹ ਯੋਗਾ ਕਰਨ ਬਾਰੇ ਸੋਚ ਰਿਹਾ ਸੀ ਤੁਸੀਂ ਕੁਛ ਮੈਨੂੰ ਜਾਣਕਾਰੀ ਦੇ ਸਕਦੇ ਹੋ ਤੁਹਾਡੇ ਕੋਲ ਕੋਈ ਟਾਈਮ ਹੈਗਾ ਵਾ ਹਾਂਜੀ ਹਾਂਜੀ ਬਸ ਤੁਹਾਨੂੰ ਇਹ ਬਾਰੇ ਪੁੱਛਣਾ ਚਾਹੁੰਦਾ ਸੀ ਕਿ ਅੱਜ ਕੱਲ੍ਹ ਜਿਹੜੇ ਲੋਕ ਬਹੁਤ ਕਹਿ ਰਹੇ ਕਿ ਯੋਗਾ ਕਰਨਾ ਚਾਹੀਦਾ ਯੋਗਾ ਕਰਨਾ ਚਾਹੀਦਾ ਮੈਂ ਇਹ ਪੁੱਛਣਾ ਚਾਅ ਰਿਹਾ ਸੀ ਕਿ ਯੋਗਾ ਕਰਨ ਦੇ ਨਾ ਫ਼ਾਇਦੇ ਕੀ ਹੈਗੇ ਕੀ ਕੀ ਫ਼ਾਇਦੇ ਮਤਲਬ ਆਪਾਂ ਨੂੰ ਕੀ ਮਤਲਬ ਕਿਉਂ ਕਰਨੀ ਚਾਹੀਦੀ ਯੋਗਾ ਅੱਛਾ ਜੀ ਜਿਹੜੇ ਵਿਦਿਆਰਥੀਆਂ ਲਈ ਹੈਗਾ ਵਾ ਉਹ ਕਿਹੜੇ ਕਿਹੜੇ ਮਤਲਬ ਆਸਣ ਜ਼ਰੂਰੀ ਹੈਗੇ ਅਤੇ ਮਤਲਬ ਵਿਦਿਆਰਥੀਆਂ ਲਈ ਵਧੀਆ ਚੀਜ਼ ਹੁੰਦੀ ਹੈ ਯੋਗਾ ਹਾਂਜੀ ਇਹ ਤਾਂ ਬਹੁਤ ਵਧੀਆ ਗੱਲ ਹੈ ਜੀ ਕੀ ਇਹ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਇਹ ਮੈਂ ਘਰ ਵਿੱਚ ਕਰ ਸਕਦਾ ਜਿੱਦਾਂ ਕਿ ਮੈਨੂੰ ਕਿਤੇ ਬਾਹਰ ਟਾਈਮ ਨਹੀਂ ਮਿਲਦਾ ਕਿਉਂਕਿ ਘਰ ਆ ਕੇ ਟਾਈਮ ਮਿਲਦਾ ਵਾ ਕਿ ਮੈਂ ਘਰ ਆ ਕੇ ਕਰ ਸਕਦਾ ਆਸਣ ਇਹ ਠੀਕ ਹੈ ਜੀ ਤੁਹਾਡਾ ਧੰਨਵਾਦ ਮੈਨੂੰ ਬਹੁਤ ਮਦਦ ਮਿਲੀ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਦਾ ਹਾਂ ਠੀਕ ਹੈ ਜੀ ਬਿਲਕੁਲ ਜੀ ਧੰਨਵਾਦ ਸਤਿ ਸ਼੍ਰੀ ਅਕਾਲ